ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਕੋਲੋਂ ਪੰਦਰ੍ਹਾਂ ਦਿਨ ਪਹਿਲਾਂ ਇੱਕ ਬੈਡਸ਼ੀਟ ਔਡਰ ਕੀਤੀ ਸੀ ਅਤੇ ਜਿਸਦੀ ਪੈਕੇਜਿੰਗ ਵੀ ਬਹੁਤ ਵਧੀਆ ਸੀ ਅਤੇ ਔਡਰ ਟਾਈਮ ਨਾਲ ਪਹੁੰਚ ਵੀ ਗਿਆ ਸੀ ਅਤੇ ਉਹਦਾ ਕਲਰ ਬਹੁਤ ਵਧੀਆ ਸੀ ਅਤੇ ਕੋਟਨ ਦਾ ਸਟੱਫ਼ ਵੀ ਬਹੁਤ ਵਧੀਆ ਸੀ ਅਤੇ ਹੁਣ ਤੱਕ ਧੋਣ ਤੋਂ ਬਾਅਦ ਵੀ ਉਸਦਾ ਕਲਰ ਨਹੀਂ ਉਤਰਿਆ ਅਤੇ ਜਿਵੇਂ ਦਾ ਕਲਰ ਮੈਂ ਮੰਗਵਾਇਆ ਸੀ ਉਵੇਂ ਦਾ ਹੀ ਕਲਰ ਸੀ ਅਤੇ ਉਸ ਤੋਂ ਵੀ ਵਧੀਆ ਕਲਰ ਸੀ ਉਹ ਅਤੇ ਕੁਆਲਿਟੀ ਤਾਂ ਉਸ ਤੋਂ ਵੀ ਜ਼ਿਆਦਾ ਵਧੀਆ ਸੀ ਪ੍ਰਿੰਟ ਵੀ ਉਸਦਾ ਬਹੁਤ ਵਧੀਆ ਸੀ ਜੋ ਕਿ ਘਰ ਵਿੱਚ ਵੀ ਸਭ ਨੂੰ ਪਸੰਦ ਆਇਆ ਅਤੇ ਆਂਡੀ ਗੁਵਾਂਢੀਆਂ ਨੂੰ ਦਿਖਾਉਣ ਤੋਂ ਬਾਅਦ ਵੀ ਉਹਨਾਂ ਨੂੰ ਵੀ ਬਹੁਤ ਪਸੰਦ ਆਇਆ ਅਤੇ ਮੈਨੂੰ ਮਾਰਕਿਟ ਨਾਲੋਂ ਵੀ ਬਹੁਤ ਜ਼ਿਆਦਾ ਸਸਤੀ ਪਈ ਆ ਅਤੇ ਇੱਕ ਦੋ ਵਾਰੀ ਇਕ ਦੋ ਜਣਿਆਂ ਦਾ ਵੀ ਮੈਂ ਹੋਰ ਔਡਰ ਕੀਤਾ ਸੀ ਅਤੇ ਉਹਨਾਂ ਅਤੇ ਉਹਨਾਂ ਨੂੰ ਵੀ ਬਹੁਤ ਪਸੰਦ ਆਈ ਆ ਤੁਹਾਡੇ ਵੱਲੋਂ ਕੁਆਲਿਟੀ ਵਧੀਆ ਭੇਜੀ ਗਈ ਚਾਦਰ ਦੀ ਮੈਂ ਅਤੇ ਅਤੇ ਉਹਨਾਂ ਦਾ ਔਡਰ ਵੀ ਟਾਈਮ ਸਿਰ ਪਹੁੰਚ ਗਿਆ ਸੀ ਅਤੇ ਉਸ ਤੋਂ ਬਾਅਦ ਤੁਹਾਡਾ ਡਿਲੀਵਰੀ ਬੋਆਏ ਵੀ ਬਹੁਤ ਚੰਗਾ ਸੀ ਅਤੇ ਮੇਰੇ ਤੋਂ ਕੋਈ ਐਕਸਟਰਾ ਡਿਲੀਵਰੀ ਦੇ ਪੈਸੇ ਵੀ ਨਹੀਂ ਲੈ ਕੇ ਗਿਆ